ਹਾਂ ਅਸੀਂ ਮੰਨਦੇ ਹਾਂ ਕਿ ਅੱਜ ਕੱਲ੍ਹ ਦੇ ਬੱਚੇ ਗੇਮਾਂ ਵੱਲ ਧਿਆਨ ਨਹੀਂ ਦਿੰਦੇ ਉਹ ਸਕੂਲ ਤੋਂ ਆਉਂਦੇ ਹੀ ਫੋਨ ਲੈ ਕੇ ਬੈਠ ਜਾਂਦੇ ਹਨ ਅਤੇ ਫਰੀ ਫਾਇਰ ਪਬਜੀ ਇੰਸਟਾਗ੍ਰਾਮ ਖੇਡਣ ਲੱਗਦੇ ਹਨ ਇੰਸਟਾਗ੍ਰਾਮ ਚਲਾਉਣ ਦੇ ਵਿੱਚ ਚਲਾਉਂਦੇ ਹਨ ਯੂਟਿਊਬ ਵੀ ਚਲਾਉਂਦੇ ਹਨ ਅਤੇ ਕਾਰਟੂਨ ਵੀ ਦੇਖਦੇ ਹਨ ਸਕਰੀਨ 'ਚੋਂ ਹੀ ਅਤੇ ਦੋ ਦੋ ਤਿੰਨ ਤਿੰਨ ਘੰਟੇ ਉਸ ਫੋਨ ਵੱਲ ਹੀ ਦੇ ਉਹਨਾਂ ਦਾ ਧਿਆਨ ਰਹਿੰਦਾ ਹੈ ਅਤੇ ਖਾਣ ਪੀਣ ਵੱਲ ਕੋਈ ਵੀ ਅਤੇ ਬਾਹਰਲੀ ਫਿਜੀਕਲੀ ਉਹਨਾਂ ਦਾ ਅੱਖਾਂ ਵੀ ਖਰਾਬ ਹੋ ਜਾਂਦਾ ਹੈ ਇਸ ਕਾਰਨ ਉਹਨਾਂ ਨੂੰ ਅੱਖਾਂ ਦ ਦਾ ਸਪੈਕਸ ਵੀ ਲੱਗ ਜਾਂਦਾ ਹੈ ਅਤੇ ਉਹ ਬਾਹਰ ਬਾਹਰ ਜਾ ਕੇ ਖੇਡਦੇ ਵੀ ਨਹੀਂ ਅਤੇ ਉਨ੍ਹਾਂ ਦਾ ਖਾਣ ਵੱਲ ਵੀ ਪੂਰਾ ਧਿਆਨ ਨਹੀਂ ਹੁੰਦਾ ਔਰ ਉਹ ਉਹਨਾਂ ਦਾ ਪੜ੍ਹਾਈ ਵੱਲ ਵੀ ਧਿਆਨ ਨਹੀਂ ਚੰਗੀ ਤਰ੍ਹਾਂ ਹੁੰਦਾ ਅਤੇ ਉਹ ਫਿਟ ਵੀ ਨਹੀਂ ਹਨ ਔਰ ਉਹਨਾਂ ਔਰ ਉਹਨਾਂ ਨੂੰ ਔਰ ਤੁਹਾਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਫੋਨ ਨਾ ਦਿਉ ਅਤੇ ਉਹਨਾਂ ਨੂੰ ਖਾਣ ਪੀਣ ਵੱਲ ਧਿਆਨ ਦਿਉ ਔਰ ਉਹਨਾਂ ਨੂੰ ਬਾਹਰ ਭੇਜੋ ਖੇਡਣ ਲਈ ਤਾਂ ਕਿ ਉਹਨਾਂ ਨੂੰ ਤੰਦਰੁਸਤੀ ਰਹੇ ਹੋਰ ਬੱਚਿਆਂ ਨੂੰ ਦਿਮਾਗ ਵੀ ਤੇਜ਼ ਰਹੇ ਇਸ ਲਈ ਪੜ੍ਹਾਈ ਵੱਲ ਧਿਆਨ ਦੇਵੇ ਬੱਚਾ ਉਹਨਾਂ ਨੂੰ ਧਿਆਨ ਦਿਉ ਫਿੱਟ ਰਹੇ